ਪੰਜਾਬੀ ਸੱਭਿਆਚਾਰ ਦੇ ਵਿੱਚ ਭੰਗੜੇ ਦੀ ਨਿਵੇਕਲੀ ਮਹੱਤ ਮਹੱਤਤਾ ਹੈ ਸੋ ਪੰਜਾਬੀ ਭੰਗੜੇ ਨੂੰ ਨੌਜਵਾਨ ਜੋ ਹਨ ਉਹ ਸਿਰਾਂ ਦੇ ਉੱਪਰ ਪਗੜੀ ਸਜਾ ਕੇ ਅਤੇ ਕੁੜਤੇ ਲੰਬੇ ਕੁੜਤੇ ਪਾ ਕੇ ਨਾਲ ਚਾਦਰੇ ਬੰਨ ਕੇ ਅਤੇ ਹੱਥਾਂ ਦੇ ਵਿੱਚ ਸੰਮਾਂ ਵਾਲੀਆਂ ਡਾਂਗਾਂ ਲੈ ਕੇ ਅਤੇ ਉਹ ਭੰਗੜੇ ਪਾਉਂਦੇ ਹਨ ਅਤੇ ਆਮ ਤਿਉਹਾਰਾਂ ਦੇ ਵਿੱਚ ਇਸ ਭੰਗੜੇ ਨੂੰ ਜੋ ਪੰਜਾਬੀ ਲੋਕ ਬੜੇ ਹੀ ਉਤਸ਼ਾਹ ਦੇ ਨਾਲ ਵੇਖਦੇ ਹਨ ਅਤੇ ਬੜਾ ਹੀ ਉਤਸ਼ਾਹ ਦੇ ਨਾਲ ਜੋ ਇਸ ਭੰਗੜੇ ਵਾਲੇ ਨੌਜਵਾਨਾਂ ਦਾ ਜੋ ਸਨਮਾਨ ਕੀਤਾ ਜਾਂਦਾ ਹੈ